ਜਦੋਂ ਬਰਤਨ ਧੋਨਾ ਹੋਵੇ ਪਹਿਲਾਂ ਉਹਨੂੰ ਸਭ ਤੋਂ ਪਹਿਲਾਂ ਸਾਫ ਪਾਣੀ ਨਾਲ ਧੋਨੇ ਆ ਜਿਹੜੀ ਉਹਦੇ ਵਿੱਚ ਦਾਲ ਵਗੈਰਾ ਲੱਗੀ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਤਾ ਜਾਂਦਾ ਫਿਰ ਉਹਨੂੰ ਸਾਈਡ ਤੇ ਰੱਖ ਲੈਨੇ ਆ ਧੋਤੇ ਹੋਏ ਬਰਤਨਾਂ ਨੂੰ ਫਿਰ ਉਹਨਾਂ ਦੇ ਵਿੱਚ ਸਾਰਿਆਂ ਦੇ ਸਾਬਣ ਨਾਲ ਸਰਫ ਲਾਉਦੇ ਆਗੇ ਸਰਫ ਲਾ ਕੇ ਫਿਰ ਉਹਨੂੰ ਫਿਰ ਪਾਣੀ ਨਾ ਧੋਨੇ ਆਂ ਫਿਰ ਇੱਕ ਵਾਰ ਜਦੋਂ ਬਰਤਨ ਤੇ ਸਾਬਣ ਲਾ ਕੇ ਧੋ ਲਈਏ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਉਹਨੂੰ ਇੱਕ ਹੋਰ ਸਾਫ ਪਾਣੀ ਚ ਧੋਨੇ ਆ ਤੇ ਫਿਰ ਉਹਨੂੰ ਇਸ ਤਰ੍ਹਾਂ ਹੀ ਬਰਤਨ ਨੂੰ ਸਾਫ ਹੋ ਜਾਂਦੇ ਆ ਤੇ ਜਿਹੜੇ ਤੇਲ ਵਾਲੇ ਬਰਤਨ ਹੁੰਦੇ ਆ ਉਹਨਾਂ ਵਿੱਚ ਸਬਜ਼ੀ ਜਿਆਦਾ ਉਹਦੇ ਵਿੱਚ ਘਿਉ ਜੰਮ ਜਾਂਦਾ ਜਾਂ ਤੇਲ ਲੱਗਿਆ ਰਹਿ ਜਾਂਦਾ ਉਹਨਾਂ ਨੂੰ ਧੋਣਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਪਹਿਲਾਂ ਉਹਨਾਂ ਨੂੰ ਜਾ ਤਾਂ ਉਹਨਾਂ ਦੇ ਵਿੱਚ ਗਰਮ ਪਾਣੀ ਪਾ ਕੇ ਉਹਨਾਂ ਨੂੰ ਗਰਮ ਕਰ ਲਓ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਪਾਣੀ ਗਰਮ ਹੋ ਜੇ ਫਿਰ ਲਾ ਕੇ ਚੋ ਗਰਮ ਪਾਣੀ ਕੱਢ ਫਿਰ ਉਹਨਾਂ ਚ ਸਰਫ ਲਾ ਲੈਨੇ ਆ ਸਰਫ ਲਗਾ ਕੇ ਉਹਨਾਂ ਨੂੰ ਫਿਰ ਸਾਫ ਪਾਣੀ ਨਾਲ ਧੋ ਲੈਦੇ ਆ ਜੇ ਫਿਰ ਵੀ ਉਹਦੇ ਵਿੱਚ ਧੰਦਿਆਈ ਵਗੈਰਾ ਲੱਗੀ ਰਹਿ ਜਾਵੇ ਫਿਰ ਉਸਨੂੰ ਇੱਕ ਵਾਰ ਫੇਰ ਗਰਮ ਪਾਣੀ ਪਾ ਕੇ ਬਾਜ਼ਾਰ ਵਿੱਚ ਅੱਜ ਕੱਲ ਸੋਡੇ ਵੀ ਇਦਾਂ ਦੇ ਆ ਇਸ ਤਰ੍ਹਾਂ ਦੇ ਆਉਂਦੇ ਆ ਜਿਹੜੇ ਉਹ ਤੇਲ ਨੂੰ ਚੰਗੀ ਤਰਹਾਂ ਲਾ ਦਿੰਦੇ ਆ ਫਿਰ ਉਹਨੂੰ ਦੁਬਾਰਾ ਉਹਦੇ ਵਿੱਚ ਕੋਈ ਵੀ ਸਰਫ ਜਦੋਂ ਗਰਮ ਪਾਣੀ ਆਪਾਂ ਤੇਲ ਆਲੇ ਬਰਤਨਾਂ ਚ ਪਾ ਲੈਦੇ ਆ ਤੇ ਉਹਦੇ ਵਿੱਚ ਉਹਦੇ ਚ ਸਾਬਣ ਲਾ ਕੇ ਉਹਨੂੰ ਫੇਰ ਇੱਕ ਵਾਰ ਧੋ ਦੋ ਦੋ ਫਿਰ ਉਹ ਬਿਲਕੁਲ ਸਾਫ ਹੋ ਜਾਂਦਾ